ਭਾਅ ਜੀ ਮੇਰੇ ਫਰੈਂਡ ਨੇ ਤੁਹਾਡੀ ਦੁਕਾਨ ਬਾਰੇ ਰੈਫਰ ਕੀਤਾ ਸੀ ਕਿ ਤੁਹਾਡੇ ਕੋਲ ਹਰ ਇੱਕ ਬਰੈਂਡ ਦੇ ਸ਼ੂਜ਼ ਅਵਲੇਬਲ ਹੋ ਜਾਂਦੇ ਆ ਅਤੇ ਰੇਟ ਵੀ ਪੂਰਾ ਜੈਨੂਅਨ ਹੁੰਦਾ ਵਾ ਅਤੇ ਬਾਈ ਕਿਹੜੇ ਕਿਹੜੇ ਬਰੈਂਡ ਦੇ ਸ਼ੂਜ਼ ਨੇ ਤੁਹਾਡੇ ਕੋਲ ਐਡੀਦਾਸ ਦਾ ਕਿੱਦਾਂ ਰੇਂਜ ਭਾਅ ਜੀ ਭਾਅ ਜੀ ਆਹ ਥੋੜ੍ਹਾ ਜ਼ਿਆਦਾ ਹੋ ਗਿਆ ਤੁਸੀਂ ਥੋ ਡਿਸਕਾਊਂਟ ਡਿਸਕਾਊਂਟ ਪਾ ਦਿਓ ਇਹਤੇ ਅੱਛਾ ਅਤੇ ਉੱਦਾਂ ਜੇ ਲੈਣਾ ਹੋਇਆ ਤਾਂ ਡਿਲੀਵਰੀ ਕਰ ਦਿੰਦੇ

ਓਕੇ ਭਾਅ ਜੀ ਅਤੇ ਮੈਂ ਦੇਖਦਾ ਆਪਣੇ ਫਰੈਂਡ ਨਾਲ ਸਲਾਹ ਮਾਰ ਕੇ ਕਿਹੜਾ ਵਧੀਆ ਲੱਗਦਾ ਉਹ ਕਰਦਾ ਔਡਰ ਫਿਰ ਤੁਸੀਂ ਕੂਪਨ ਦੇ ਦਿਓ ਮੈਨੂੰ ਜਰਾ ਓਕੇ ਬਾਏ ਭਾਅ ਜੀ